ਭਾਅ ਜੀ ਤੁਸੀਂ ਸ਼ਾਮਾ ਢਾਬੇ ਤੋਂ ਬੋਲਦੇ ਹੋ ਅਸੀਂ ਦੋ ਘੰਟੇ ਪਹਿਲਾਂ ਤੁਹਾਡੇ ਤੋਂ ਸ਼ਾਹੀ ਪਨੀਰ ਕੜਾਹੀ ਪਨੀਰ ਕੜੀ ਚਾਵਲ ਰਾਜਮਾਂਹ ਚਾਵਲ ਮੰਗਵਾਏ ਸਨ ਇਸ ਆਡਰ ਵਿੱਚ ਮੈਂ ਤੁਹਾਨੂੰ ਮੈਂ ਕੁਝ ਹੋਰ ਵੀ ਸ਼ਾਮਲ ਕਰਨਾ ਚਾਹੁੰਦੀ ਹਾਂ ਜੂਸ ਵਗੈਰਾ ਸ਼ਾਮਲ ਕਰਨਾ ਚਾਹੁੰਦੀ ਜਿਵੇਂ ਕਿ ਕੌਕ ਜੁ ਜੂਸ ਮਕ ਆਦਿ ਇਹ ਸਾਨੂੰ ਤੁਸੀਂ ਦੱਸ ਦਿਉ ਤੁਸੀਂ ਪੇਮੈਂਟ ਔਫਲਾਈਨ ਲੇੈਣੀ ਹੈ ਜਾਂ ਔਨਲਾਈਨ ਅਤੇ ਤੁਸੀਂ ਕਿੰਨੇ ਸਮੇਂ ਤੱਕ ਸਾਨੂੰ ਔਡਰ ਪਹੁੰਚਾ ਸਕਦੇ ਹੋ ਧੰਨਵਾਦ